ਅੱਜ ਕੱਲ੍ਹ ਦੀ ਟੈਕਨੋਲਜੀ ਨੇ ਵੀਡੀਓ ਕਾਨਫਰੰਸ ਅਤੇ ਰਿਮੋਟ ਮੀਟਿੰਗਾਂ ਨੂੰ ਬਹੁਤ ਹੀ ਆਸਾਨ ਬਣਾ ਤਾ ਹੈ ਜੂਮ ਗੂਗਲ ਮੀਟ ਮਾਈਕ੍ਰੋਸੋਫਟ ਟੀਮਸ ਵਰਗੇ ਐਪ ਦੁਆਰਾ ਲੋਕ ਕਿਸੇ ਵੀ ਕੋਨੇ ਤੋਂ ਆਪਣੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ ਜਿਸ ਨਾਲ ਸਮਾਂ ਅਤੇ ਪੈਸੇ ਦੀ ਬਚਤ ਹੁੰਦੀ ਹੈ ਖ਼ਾਸ ਕਰਕੇ ਕੋਵਿਡ ਨਾਈਨਟੀਨ ਮਹਾਂਮਾਰੀ ਦੇ ਦੌਰਾਨ ਇਹ ਤਕਨੀਕ ਇੱਕ ਬਹੁਤ ਵੱਡਾ ਉਪਕਾਰ ਸਾਬਤ ਹੋਈ ਜਦੋਂ ਲੋਕ ਘਰ ਬੈਠੇ ਕੰਮ ਕਰ ਸਕਦੇ ਸਨ ਇਹਦੇ ਵਿੱਚ ਜੋ ਚੰਗਾ ਹੈ ਉਹ ਹੈ ਸਹੂਲਤ ਅਤੇ ਸਮੇਂ ਦੀ ਬਚਤ ਵਿਦੇਸ਼ੀ ਲੋਕਾਂ ਨਾਲ ਜੁੜਨ ਦਾ ਮੌਕਾ ਕੋਲ ਰਿਕਾਰਡਿੰਗ ਅਤੇ ਦਸਤਾਵੇਜ਼ ਸਾਂਝੇ ਕਰਨ ਦਾ ਇੱਕ ਜ਼ਰੀਆ ਹੁਣ ਸਹੂਲਤ ਦੇ ਸਮੇਂ ਦੇ ਬਚਤ ਵਿੱਚ ਕਿਸੇ ਨੂੰ ਵੀ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਘਰ ਜਾਂ ਦਫ਼ਤਰ ਵਿੱਚ ਬੈਠ ਕੇ ਵੀ ਮੀਟਿੰਗ ਨੂੰ ਅਟੈਂਡ ਕਰ ਸਕਦਾ ਹੈ ਵਿਦੇਸ਼ੀ ਲੋਕਾਂ ਨਾਲ ਜਿਵੇਂ ਰਿਮੋਟ ਮੀਟਿੰਗਾਂ ਦੁਆਰਾ ਅਲੱਗ ਅਲੱਗ ਸ਼ਹਿਰਾਂ ਅਤੇ ਦੇਸ਼ਾਂ ਵਿੱਚ ਬੈਠੇ ਲੋਕ ਆਸਾਨੀ ਨਾਲ ਤੁਹਾਡੇ ਨਾਲ ਜੁੜ ਸਕਦੇ ਹਨ ਕੋਲ ਰਿਕਾਰਡਿੰਗ ਅਤੇ ਦਸਤਾਵੇਜ਼ ਵੀ ਅਸੀਂ ਇੱਕ ਦੂਜੇ ਨੂੰ ਸ਼ੇਅਰ ਕਰਨਾ ਬਹੁਤ ਆਸਾਨੀ ਨਾਲ ਹੋ ਜਾਂਦਾ ਹੈ ਹੁਣ ਇਹਦੇ ਵਿੱਚ ਜੋ ਚੰਗਾ ਨਹੀਂ ਹੈ ਉਹ ਹੈ ਜਿਵੇਂ ਇੰਟਰਨੈਟ ਦੀ ਆਸਰੇਤਾ ਜੇਕਰ ਇੰਟਰਨੈਟ ਕਮਜ਼ੋਰ ਹੋਵੇ ਤਾਂ ਆਵਾਜ਼ ਅਤੇ ਵੀਡੀਓ ਦੀ ਗੁਣਵੱਤਾ ਵਿਗੜ ਜਾਂਦੀ ਹੈ ਅਤੇ ਅਸੀਂ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰ ਪਾਉਂਦੇ ਪ੍ਰਾਕਰਤਿਕ ਸੰਪਰਕ ਜੋ ਹੈ ਹੁਣ ਇਹ ਦੂਰ ਕਰ ਦਿੰਦਾ ਹੈ ਕਿਉਂਕਿ ਜੋ ਅਸਲ ਵਿੱਚ ਇੱਕ ਦੂਜੇ ਨੂੰ ਮਿਲਣਾ ਹੈ ਉਹ ਚੀਜ਼ ਅਲੱਗ ਹੈ ਪਰ ਪਰਦੇ 'ਤੇ ਚਿਹਰੇ ਵੇਖਣ ਨਾਲ ਉਹ ਜਿਹਾ ਅਹਿਸਾਸ ਨਹੀਂ ਹੁੰਦਾ ਧਿਆਨ ਭਟਕਣ ਦਾ ਖ਼ਤਰਾ ਜਿਵੇਂ ਘਰਾਂ ਜਾਂ ਦੂਜੇ ਆਨਲਾਈਨ ਕੰਮਾਂ ਕਰਕੇ ਵਿਅਕਤੀ ਪੂਰੀ ਤਰ੍ਹਾਂ ਮੀਟਿੰਗ 'ਤੇ ਧਿਆਨ ਨਹੀਂ ਦੇ ਸਕਦਾ ਜੋ ਆਖਰੀ ਗੱਲ ਹੈ ਟੈਕਨੋਲਜੀ ਦੀ ਇਹ ਇੱਕ ਵੱਡੀ ਭੇਂਟ ਹੈ ਪਰ ਇਹ ਹਮੇਸ਼ਾ ਹਕੀਕਤੀ ਮਿਲਟ ਅਤੇ ਮਿਲਣ ਜੁਲਣ ਦੀ ਜਗ੍ਹਾ ਨਹੀਂ ਲੈ ਸਕਦੇ ਇਸ ਦਾ ਵਧੀਆ ਤਰੀਕਾ ਇਹ ਹੈ ਕਿ ਟੈਕਨੋਲਜੀ ਅਤੇ ਪ੍ਰਾਕ੍ਰਿਤਿਕ ਸੰਪਰਕ ਵਿਚਾਲੇ ਇੱਕ ਸੰਤੁਲਨ ਬਣਾਇਆ ਜਾਵੇ